ਵੈਸੇ ਤਾਂ ਮੇਰੀ ਰੁਚੀ ਕਾਫੀ ਸਾਰੀ ਚੀਜ਼ਾਂ 'ਚ ਹੈ ਪਰ ਜੇ ਤੁਸੀਂ ਮਤਲਬ ਸਿੰਗਿੰਗ ਦੀ ਗੱਲ ਕਰਦੇ ਹੋ ਤਾਂ ਮੇਰੀ ਜਿਹੜੀ ਰੁਚੀ ਆ ਇਹਦੇ ਵਿੱਚ ਕਿੱਦਾਂ ਹੋਈ ਮੈਂ ਸਾਡੇ ਪਿੰਡ ਇੱਕ ਹਰ ਸਾਲ ਜਿਹੜਾ ਉਹ ਛਿੰਝ ਮੇਲਾ ਕਰਵਾਇਆ ਜਾਂਦਾ ਜੋ ਕਿ ਸਪਤੰਬਰ ਮਹੀਨੇ ਵਿੱਚ ਹੁੰਦਾ ਤਾਂ ਮਤਲਬ ਪਿਛਲੀ ਵਾਰ ਸਪਤੰਬਰ ਮਹੀਨੇ ਸਾਡੇ ਇੱਧਰ ਸਾਡੇ ਪਿੰਡ ਮੇਲਾ ਸੀ ਤਾਂ ਮੈਂ ਆਪਣੇ ਪਾਪਾ ਨਾਲ ਮੇਲਾ ਵੇਖਣ ਗਈ ਅਤੇ ਉੱਥੇ ਗੁਰਨਾਮ ਭੁੱਲਰ ਨੂੰ ਮੇਲੇ ਵਿੱਚ ਬੁਲਾਇਆ ਗਿਆ ਸੀ ਤਾਂ ਉੱਥੇ ਮੈਂ ਉਹਨਾ ਉਹਨਾਂ ਦੀ ਆਵਾਜ਼ ਸੁਣ ਕੇ ਬਹੁਤ ਜ਼ਿਆਦਾ ਇੰਸਪਾਇਰ ਹੋਈ ਮੈਨੂੰ ਬਹੁਤ ਅੱਛਾ ਲੱਗਿਆ ਉਹਨਾਂ ਦੀ ਆਵਾਜ਼ ਸੁਣ ਕੇ ਫਿਰ ਘਰ ਆ ਕੇ ਮੈਂ ਆਪਣੇ ਪਾਪਾ ਕੋਲ ਉਹਨਾਂ ਬਾਰੇ ਪੁੱਛਿਆ ਫਿਰ ਮੈਂ ਉਹਨਾਂ ਬਾਰੇ ਨੈਟ ਨੈਟ 'ਤੇ ਸਰਚ ਕੀਤਾ ਉਹਨਾਂ ਦੇ ਯੂਟੀਊਬ 'ਤੇ ਕਾਫੀ ਸਾਰੇ ਗਾਣੇ ਜਿਹੜੇ ਸੁਣੇ ਔਰ ਮਤਲਬ ਮੈਨੂੰ ਪਹਿਲਾਂ ਤੋਂ ਹੀ ਗਾਣਾ ਜਿਹੜਾ ਬਹੁਤ ਅੱਛਾ ਲੱਗਦਾ ਸੀ ਅਤੇ ਉਹਨਾਂ ਦੀ ਆਵਾਜ਼ ਨੂੰ ਸੁਣ ਕੇ ਫਿਰ ਉਹਨਾਂ ਦੀ ਜਿਹੜੀ ਹੈ ਉਹ ਮਹਾਨਤਾ ਦੇਖਿਆ ਉਹਨਾਂ ਨੂੰ ਕਿੱਥੇ ਕਿੱਥੇ ਕਿਹੜੇ ਕਿਹੜੇ ਪ ਪ੍ਰਾਈਜ਼ ਵਗੈਰਾ ਜਿਹੜੇ ਆ ਉਹ ਡਿਸਟਰੀਬਿਊਟ ਕੀਤੀ ਗਏ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਮੈਂ ਹੁਣ ਤਾਂ ਹੁਣ ਤੱਕ ਤਾਂ ਮੈਨੂੰ ਕਾਫੀ ਟਾਈਮ ਹੋ ਗਿਆ ਗਾਣਾ ਗਾਉਂਦੇ ਮਤਲਬ ਮੈਂ ਮੈਂ ਚਾਹੁੰਦੀ ਹਾਂ ਕਿ ਮੈਂ ਆਪਣੀ ਆਵਾਜ਼ ਨੂੰ ਜਿਹੜਾ ਉਹ ਲੋਕਾਂ ਤੱਕ ਪਹੁੰਚਾਵਾਂ ਅਤੇ ਇਸ ਨੂੰ ਹੋਰ ਵੀ ਵਧੀਆ ਕਰਾਂ ਤਾਂ ਜੋ ਮੈਂ ਵਧੀਆ ਗਾ ਸਕਾਂ ਧੰਨਵਾਦ